ਪੰਜਾਬੀ ਭਾਸ਼ਾ ਦਾ ਪੰਜਾਬ ਦੇ ਵਿੱਚ ਅਹਿਮ ਰੋਲ ਹੈ ਕਿਉਂਕਿ ਪੰਜਾਬੀ ਪੰਜਾਬ ਦੀ ਮਾਤ ਭਾਸ਼ਾ ਹੈਗੀ ਐ ਸਾਡੀ ਬੋਲੀ ਮਾਂ ਬੋਲੀ ਪੰਜਾਬੀ ਹੈ ਪੰਜਾਬੀ ਨੂੰ ਅਸੀਂ ਪ੍ਰਮੋਟ ਕਰਨਾ ਚਾਹੁੰਦੇ ਹਾਂ ਜਦੋਂ ਕਿ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਜਿਹੜੇ ਸੀ ਬੀ ਐੱਸ ਸੀ ਸਕੂਲ ਹੈ ਉਹਦੇ ਵਿੱਚ ਪੰਜਾਬੀ ਪੜ੍ਹਾਉਣ 'ਤੇ ਵੀ ਬੱਚਿਆਂ ਨੂੰ ਫਾਈਨ ਲਗਾ ਦਿੱਤਾ ਜਾਂਦਾ ਹੈ ਜਦੋਂ ਕਿ ਅਸੀਂ ਕਹਿੰਦੇ ਹਾਂ ਵੀ ਪੰਜਾਬ ਜਦੋਂ ਸਾਡਾ ਸੂਬਾ ਹੈ ਪੰਜਾਬ ਹੈ ਤਾਂ ਇਹਦੇ ਵਿੱਚ ਪੰਜਾਬੀ ਭਾਸ਼ਾ ਦੀ ਹੀ ਪੰਜਾਬੀ ਭਾਸ਼ਾ ਨੂੰ ਮੁੱਖ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਸਾਡੇ ਦਫਤਰਾਂ ਦੇ ਵਿੱਚ ਅਕਸਰ ਕੰਮ ਜਿਹੜੇ ਆ ਉਹ ਅਕਸਰ ਪੰਜਾਬੀ ਭਾਸ਼ਾ ਦੇ ਵਿੱਚ ਹੁੰਦੇ ਆ ਸਰਕਾਰੀ ਅਦਾਰਿਆਂ ਦੇ ਵਿੱਚ ਜਿਹੜੇ ਕੰਮ ਹੈ ਪੰਜਾਬੀ ਭਾਸ਼ਾ ਦੇ ਵਿੱਚ ਹੀ ਕੀਤੇ ਜਾਂਦੇ ਆ ਉਹਦੇ ਨਾਲ ਨਾਲ ਹੁਣ ਜੇ ਜਿਹੜੀ ਇੰਗਲਿਸ਼ ਹੈਗੀ ਐ ਉਹਨੂੰ ਬੜਾਵਾ ਦੇ ਰਹੇ ਆ ਅਸੀਂ ਉਸ ਚੀਜ਼ ਤੋਂ ਉੱਪਰ ਉੱਠ ਕੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਪੰਜਾਬ ਦੇ ਵਿੱਚ ਸਿਰਫ ਜੋ ਵੀ ਕੰਮ ਹੈ ਸਾਡਾ ਪੰਜਾਬ ਦੇ ਵਿੱਚ ਪੰਜਾਬੀ ਦੇ ਵਿੱਚ ਹੀ ਹੋਣਾ ਚਾਹੀਦਾ ਹੈ ਜਿੰਨੇ ਵੀ ਸਾਡੇ ਸਾਈਨ ਬੋਰਡ ਲੱਗੇ ਆ ਮਾਈਲਸਟੋਨ ਲੱਗੇ ਆ ਉਹਨਾਂ ਦੇ ਵਿੱਚ ਵੀ ਪੰਜਾਬੀ ਹੀ ਉਕੇਰੀ ਗਈ ਹੈ ਲਿਖੀ ਗਈ ਹੈ ਪੰਜਾਬੀ ਦਾ ਹੋਣਾ ਸਾਡੇ ਲਈ ਬਹੁਤ ਅਹਿਮ ਹੈ ਕਿਉਂਕਿ ਪੰਜਾਬੀ ਭਾਸ਼ਾ ਜਿਹੜੀ ਹੈ ਸਾਡੀ ਬਹੁਤ ਸੁਚੱਜੀ ਅਤੇ ਸਾਫ ਅਤੇ ਸੁੰਦਰ ਬੋਲੀ ਹੈ ਪੰਜਾਬ ਦੀ ਬੋਲੀ ਜਿਹੜੀ ਹੈ ਸਾਡੀ ਸਭ ਤੋਂ ਸੁਪਰ ਡੁਪਰ ਬੋਲੀ ਹੈ ਕਿਉਂਕਿ ਇਹ ਮਾਤ ਭਾਸ਼ਾ ਸਾਡੀ ਪੰਜਾਬੀ ਹੋਣ ਕਰਕੇ ਪੰਜਾਬ ਦਾ ਨਾਮ ਪੂਰੇ ਵਰਲਡ ਹਿੰਦੁਸਤਾਨ ਦੇ ਵਿੱਚ ਗੂੰਜਦਾ ਹੈ